ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਦੇ ਕੁਛ ਤਰੀਕੇ ਇਸ ਪ੍ਰਕਾਰ ਹਨ ਸਮੁੰਦਰੀ ਲਹਿਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਤੈਰਾਕੀ ਸ਼ੁਰੂ ਕੀਤੀ ਜਾਵੇ ਕਿਸੇ ਤਰ੍ਹਾਂ ਦੀ ਅਧੂਰੀ ਜਾਣਕਾਰੀ ਨਾਲ ਤੈਰਾਕੀ ਸ਼ੁਰੂ ਨਾ ਕੀਤੀ ਜਾਵੇ ਮੌਸਮ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਤੈਰਾਕੀ ਕੀਤੀ ਜਾਣੀ ਚਾਹੀਦੀ ਹੈ ਇੱਕ ਯੂ ਐੱਸ ਸੀ ਜੀ ਅਪਰੂਵਡ ਲਾਈਫ ਵੈਸ਼ਟ ਪਹਿਨ ਕੇ ਤੈਰਾਕੀ ਕੀਤੀ ਜਾਵੇ ਆਪਣੀਆਂ ਕਮੀਆਂ ਅਤੇ ਆਪਣੀਆਂ ਖੂਬੀਆਂ ਨੂੰ ਚੰਗੀ ਤਰ੍ਹਾਂ ਪਹਿਚਾਣ ਕੇ ਤੈਰਾਕੀ ਵਿੱਚ ਹਿੱਸਾ ਲਿਆ ਜਾਵੇ ਆਪਣੀਆਂ ਹੱਦਾਂ ਨੂੰ ਜਾਣਿਆ ਜਾਵੇ ਵਧੇਰੇ ਤੋਂ ਵਧੇਰੇ ਤਰਲ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਵੇ ਹੌਸਲਾ ਵੱਧ ਤੋਂ ਵੱਧ ਬਣਾਇਆ ਜਾਵੇ ਕਦੇ ਵੀ ਇਕੱਲਿਆਂ ਤੈਰਾਕੀ ਨਾ ਕੀਤੀ ਜਾਵੇ ਮੌਸਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕੀਤੀ ਜਾਵੇ ਤਿਲਕਣ ਵਾਲੀਆਂ ਚੱਟਾਨਾਂ ਐਲਗੀ ਅਤੇ ਤੇਜਾ ਤੇਜ਼ ਵਹਾਅ ਆਦਿ ਲਈ ਕੁਛ ਰੁਕਾਵਟਾਂ ਹੋਣ ਦੇ ਰੂਪ ਵਿੱਚ ਤੈਰਾਕੀ ਨੂੰ ਤੁਰੰਤ ਹੀ ਛੱਡ ਦਿੱਤਾ ਜਾਵੇ ਅਤੇ ਤੈਰਾਕੀ ਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਮਾਨਸਿਕ ਜਾਂ ਸਰੀਰਕ ਤਣਾਉ ਤੋਂ ਮੁਕਤ ਹੋਣ ਲਈ ਇੱਕ ਯੂ ਇੱਕ ਅਦਭੁਤ ਵਾਤਾਵਰਨ ਦਾ ਨਿਰਮਾਣ ਕੀਤਾ ਜਾਵੇ